ਵੱਡੀ ਉਮਰ ਦੇ ਨਾਲ਼ ਚਾਹੇ ਉਹ ਮਨੁੱਖ ਚਾਹੇ ਉਹ ਜਾਨਵਰ ਹੈ ਦੋਨਾਂ ਦੀ ਸਮਝ ਵਿੱਚ ਸਮੇਂ ਦੇ ਨਾਲ਼ ਸਮਝ ਵਿੱਚ ਫਰਕ ਪੈ ਪੈਂਦਾ ਰਹਿੰਦਾ ਹੈ ਇੱਦਾਂ ਹੀ ਮੈਂ ਜਦੋਂ ਆਪਣੇ ਲਈ ਘੋੜਾ ਲੈ ਕੇ ਆਇਆ ਸੀ ਉਸ ਸਮੇਂ ਸਾਡੇ ਵਿੱਚ ਚੰਗੀ ਤਰ੍ਹਾਂ ਪਹਿਚਾਣ ਨਾ ਹੋਣ ਕਰਕੇ ਮੈਨੂੰ ਆਪਣੇ ਉੱਪਰ ਬੈਠਣ ਵੀ ਨਹੀਂ ਸੀ ਦਿੰਦਾ ਪਰ ਜਿਉਂ ਜਿਉਂ ਮੈਂ ਉਸਦਾ ਧਿਆਨ ਰੱਖਦਾ ਗਿਆ ਉਸਨੂੰ ਖਿਲਾਉਂਦਾ ਪਿਲਾਉਂਦਾ ਰਿਹਾ ਉਸ ਦੀ ਖੁਰਾਕ ਮੇਰਾ ਅਤੇ ਉਸ ਦਾ ਪਿਆਰ ਗੂੜ੍ਹਾ ਹੁੰਦਾ ਗਿਆ ਅਤੇ ਹੁਣ ਮੈਂ ਜਦ ਵੀ ਉਸ ਉੱਤੇ ਬੈਠਦਾ ਅਤੇ ਮੈਨੂੰ ਵਧੀਆ ਤਰੀਕੇ ਨਾਲ਼ ਘੋੜਸਵਾਰੀ ਕਰਵਾਉਂਦਾ ਹੈ ਇਸ ਤਰ੍ਹਾਂ ਮੇਰੇ ਅਤੇ ਉਸਦੇ ਸੰਬੰਧਾਂ ਵਿੱਚ ਬਹੁਤ ਫਰਕ ਪਿਆ